ਕੀੜੇ ਮਕੌੜਿਆਂ ਦੇ ਡੰਗਾਂ ਨੂੰ ਠੀਕ ਕਰਨ ਦੇ ਲਈ ਪਿੰਡਾਂ ਵਿੱਚ ਬਹੁਤ ਹੀ ਉਪਾਅ ਹਨ ਜੋ ਕਿ ਬਹੁਤ ਹੀ ਆਰਾਮਦਾਇਕ ਅਤੇ ਅਸਰਦਾਇਕ ਹੁੰਦੇ ਹਨ ਜੋ ਕਿ ਇਸ ਤਰ੍ਹਾਂ ਹਨ ਜਿਵੇਂ ਕਿ ਪਿੰਡਾਂ ਦੇ ਵਿੱਚ ਆਕਸਾਈਡ ਪੱਤਿਆਂ ਦਾ ਰਸ ਦਾ ਨੂੰ ਨਿਕਾਲ ਕੇ ਹੈ ਨਾ ਮੱਖੀ ਦੇ ਕੀੜੇ ਅਤੇ ਡੰਗਾਂ ਦੇ ਲਾ ਸਕਦੇ ਹਾਂ ਜਿਸ ਨਾਲ ਬਹੁਤ ਹੀ ਜ਼ਿਆਦਾ ਆਰਾਮ ਮਹਿਸੂਸ ਹੁੰਦਾ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ ਜਾਂ ਫਿਰ ਇਹਨਾਂ ਤੋਂ ਬਿਨਾਂ ਘਰਾਂ ਵਿੱਚ ਮੌਜੂਦ ਮਿੱਠਾ ਸੋਡਾ ਜਾਂ ਬੈਂਕਿੰਗ ਸੋਡਾ ਜਾਂ ਬੇਕਿੰਗ ਸੋਡਾ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਬੈਂਕਿੰਗ ਸੋਡੇ ਨੂੰ ਪਾਣੀ ਦੇ ਵਿੱਚ ਉਬਾਲ ਕੇ ਉਸਦਾ ਮਿਸ਼ਰਣ ਤਿਆਰ ਕਰਕੇ ਠੰਢੇ ਪਾਣੀ ਦੇ ਵਿੱਚ ਉਸਨੂੰ ਠੰਢਾ ਕਰਨ ਲਈ ਰੱਖ ਦਿੱਤਾ ਜਾਂਦਾ ਹੈ ਅਤੇ ਫਿਰ ਉਸਨੂੰ ਲਗਾਉਣ ਨਾਲ ਠੰਢਕ ਮਹਿਸੂਸ ਹੁੰਦੀ ਹੈ ਅਤੇ ਸੂਜਨ ਵਗੈਰਾ ਵੀ ਘੱਟ ਜਾਂਦੀ ਹੈ ਅਤੇ ਦਰਦ ਤੋਂ ਵੀ ਰਾਹਤ ਮਿਲਦੀ ਹੈ ਇਹਨਾਂ ਤੋਂ ਇਲਾਵਾ ਕਈ ਲੋਕ ਹਰਬਲ ਚਾਹ ਦੀ ਵੀ ਵਰਤੋਂ ਕਰਦੇ ਹਨ ਜਿਸ ਨਾਲ ਬਹੁਤ ਜ਼ਿਆਦਾ ਫਰਕ ਦੇਖਣ ਨੂੰ ਮਿਲਦਾ ਹੈ ਇਸਦੇ ਨਾਲ ਕੀ ਹੁੰਦਾ ਕਿ ਚਾਹ ਦੇ ਪੱਤਿਆਂ ਦੀ ਵਰਤੋਂ ਕਰਕੇ ਉਹਨਾਂ ਦਾ ਪਾਣੀ ਵਿੱਚੋਂ ਮਿਸ਼ਰਣ ਉਬਾਲ ਕੇ ਤਿਆਰ ਕਰਕੇ ਲਗਾਉਣ ਨਾਲ ਕਾਫੀ ਅਸਰ ਵੇਖਣ ਨੂੰ ਮਿਲਦਾ ਹੈ ਜਿਸ ਨਾਲ ਦਰਦ ਤੋਂ ਵੀ ਰਾਹਤ ਮਿਲੇਗੀ ਅਤੇ ਅਸਰ ਵੀ ਹੋਵੇਗਾ ਸਿਰਕੇ ਦੀ ਵੀ ਵਰਤੋਂ ਘਰਾਂ ਵਿੱਚ ਕੀਤੀ ਜਾਂਦੀ ਹੈ ਜੋ ਕਿ ਹਰ ਵੇਲੇ ਘਰ ਵਿੱਚ ਮੌਜੂਦ ਵੀ ਹੁੰਦਾ ਹੈ ਇਹ ਸਿਰਕੇ ਦੇ ਨਾਲ ਕੀ ਹੁੰਦਾ ਹੈ ਕਿ ਸਿਰਕੇ ਨੂੰ ਲਗਾਉਣ ਨਾਲ ਇਸਦੀ ਸੂਜਨ ਅਤੇ ਖੁਜਲੀ ਤੋਂ ਰਾਹਤ ਮਿਲਦੀ ਹੈ ਘੱਟ ਜਾਂਦੀ ਹੈ ਸਿਰਕੇ ਨੂੰ ਹਮੇਸ਼ਾ ਕੱਪੜੇ ਨਾਲ ਹੀ ਲਾਉਣਾ ਚਾਹੀਦਾ ਫਿਰ ਹੀ ਉਸ ਦਾ ਅਸਰ ਹੋਵੇਗਾ ਅਤੇ ਇਹਨਾਂ ਤੋਂ ਬਿਨਾਂ ਹੋਰ ਵੀ ਜੋ ਘਰ ਵਿੱਚ ਮੌਜੂਦ ਵਸਤੂਆਂ ਹੁੰਦੀਆਂ ਹਨ ਜਿਵੇਂ ਕਿ ਨਾਰੀਅਲ ਤੇਲ ਐਲੋਵੀਰਾ ਦੀ ਵਰਤੋਂ ਵੀ ਕਰ ਸਕਦੇ ਹਨ ਜਿਹਨਾਂ ਦੇ ਨਾਲ ਕੀੜੇ ਮਕੌੜੇ ਦੇ ਡੰਗਾਂ ਨੂੰ ਠੀਕ ਵੀ ਕੀਤਾ ਜਾ ਸਕਦਾ ਅਤੇ ਉਸਦੇ ਤੋਂ ਦਰਦ ਤੋਂ ਰਾਹਤ ਵੀ ਮਿਲ ਸਕਦੀ ਹੈ ਅਤੇ ਇਹ ਬਹੁਤ ਇਹ ਸਾਰੇ ਉਪਾਅ ਬਹੁਤ ਹੀ ਪਿੰਡਾਂ ਵਿੱਚ ਚਲਦੇ ਹਨ ਅਤੇ ਬਹੁਤ ਹੀ ਅਸਰਦਾਇਕ ਹੁੰਦੇ ਹਨ ਸਾਰੇ ਸਾਰੇ ਲੋਕ ਇਹਨਾਂ ਦੀ ਵਰਤੋਂ ਕਰਦੇ ਹਨ ਇਹਨਾਂ ਤੋਂ ਇਲਾਵਾ ਕਈ ਹਰਬਲ ਜਾਂ ਬੈਂਕਿੰਗ ਸੋਡਾ ਜੋਰਾਂ ਦੇ ਪੱਤੇ ਦੀ ਵੀ ਵਰਤੋਂ ਕਰਦੇ ਹਨ ਸਿਰਕੇ ਦੀ ਵਰਤੋਂ ਐਲੋਵੀਰਾ ਪੱਤਾ ਪਾਣੀ ਵਾਲਾ ਮਿਸ਼ਰਣ ਤਿਆਰ ਕਰਕੇ ਸਿਰਕੇ ਦੀ ਵਰਤੋਂ ਕਰਕੇ ਬਹੁਤ ਹੀ ਜ਼ਿਆਦਾ ਹੀ ਅਸਰਦਾਇਕ ਹੁੰਦੇ ਹਨ